ਥੋਕ ਬਾਜ਼ਾਰ ਅਤੇ ਪ੍ਰਚੂਨ ਬਾਜ਼ਾਰ ਨੂੰ ਦੇਖਿਆ ਜਾਵੇ ਤਾਂ ਮੈਂ ਬਹੁਤੀ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ ਪ੍ਰੰਤੂ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਕੱਚਾ ਮਾਲ ਹੁੰਦਾ ਹੈ ਅਤੇ ਉਹ ਆਪਣੀ ਬਾਜ਼ਾਰ ਦੇ ਵਿੱਚ ਆਉਂਦਾ ਹੈ ਐਵੇਂ ਹੀ ਥੋਕ ਨਾਲੇ ਪ੍ਰਚੂਨ ਬਾਜ਼ਾਰ ਦੀ ਹਾਲਤ ਹੈ ਹਾਲ ਹੀ ਦੇ ਵਿੱਚ ਜੇ ਕਰਿਆਨੇ ਅਤੇ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਦੇਖਣਾ ਚਾਹਵੇ ਤਾਂ ਪੰਜ ਸਾਲ ਦੇ ਵਿੱਚ ਵਿੱਚ ਹੀ ਬਹੁਤ ਉਤਰਾਅ ਚੜ੍ਹਾਅ ਦੇਖਣ ਨੂੰ ਮਿਲਦਾ ਹੈ ਉਤਰਾਅ ਚੜਾਅ ਤਾਂ ਨਹੀਂ ਕਹਿ ਸਕਦੇ ਉਤਰਾਅ ਹੀ ਆਇਆ ਕਿਉਂਕਿ ਮਹਿੰਗਾਈ ਦੇ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ ਕਰਿਆਨੇ ਦਾ ਸਮਾਨ ਮਹਿੰਗਾ ਹੋ ਰਿਹਾ ਹੈ ਕੋਈ ਵੀ ਸਮਾਨ ਲੈ ਲਉ ਚਾਹੇ ਉਹ ਫੈਸ਼ਨ ਦੇ ਤੌਰ 'ਤੇ ਹੋਵੇ ਕੱਪੜੇ ਹੋਣ ਆਪਣੀ ਕੋਈ ਵੀ ਆਇਟਮ ਦੇਖੀ ਜਾਵੇ ਤਾਂ ਉਸਦੀ ਕੀਮਤਾਂ ਵਿੱਚ ਵਾਧਾ ਆ ਰਿਹਾ ਹੈ ਕਿਉਂਕਿ ਲੋਕਾਂ ਦੀ ਡਿਮਾਂਡ ਵੀ ਵੱਧ ਰਹੀ ਹੈ ਅਤੇ ਡਿਮਾਂਡ ਵਧਣ ਦੇ ਨਾਲ ਨਾਲ ਉੱਨੀਆਂ ਕੰਪਨੀਆਂ ਚੀਜ਼ਾਂ ਦੇ ਕੀਮਤਾਂ ਨੂੰ ਵਧਾ ਰਹੀਆਂ ਹਨ ਅਤੇ ਦੂਜੇ ਪਾਸੇ ਜੇਕਰ ਅਸੀਂ ਔਨਲਾਈਨ ਖਰੀਦਦਾਰੀ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਇਹਦੇ ਲਾਭ ਵੀ ਹਨ ਅਤੇ ਹਾਨੀਆਂ ਵੀ ਹਨ ਜੇ ਲਾਭ ਦੀ ਗੱਲ ਕਰਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਘਰ ਦੇ ਅੰਦਰ ਹੀ ਸਮਾਨ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਦੂਜੀ ਇਹਦੀ ਸਭ ਤੋਂ ਬੜੀ ਹਾਨੀ ਇਹ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਜੋ ਅਸੀਂ ਚੀਜ਼ ਪ੍ਰਾਪਤ ਕਰਦੇ ਹਾਂ ਉਸਦੇ ਅੰਦਰ ਹੋਏਗਾ ਕੀ ਅਤੇ ਕੀ ਨਹੀਂ ਹੋਏਗਾ